ਹਾਂ ਅਸੀਂ ਯੂਟਿਊਬ ਤੋਂ ਕਈ ਰੈਸਪੀ ਬਣਾਉਣੀਆਂ ਸਿੱਖਦੇ ਹਾਂ ਜਿਨ੍ਹਾਂ ਨੂੰ ਅਸੀਂ ਦੂਜਿਆਂ ਦੇ ਸਵਾਦ ਦੇ ਅਨੁਸਾਰ ਵੀ ਬਣਾਉਂਦੇ ਹਾਂ ਜਿਵੇਂ ਕੋਈ ਜ਼ਿਆਦਾ ਮਿਰਚ ਖਾਂਦਾ ਹੈ ਤਾਂ ਜ਼ਿਆਦਾ ਮਿਰਚ ਪਾਉਂਦੇ ਹਾਂ ਜੇ ਘੱਟ ਖਾਂਦਾ ਹੈ ਤਾਂ ਘੱਟ ਮਿਰਚ ਪਾਉਂਦੇ ਹਾਂ ਔਰ ਇਸ ਤਰ੍ਹਾਂ ਅਸੀਂ ਜੇ ਕੋਈ ਬੱਚਿਆਂ ਵਾਸਤੇ ਰੈਸਪੀ ਬਣਾ ਰਹੇ ਹਾਂ ਅਤੇ ਉਹਦੇ ਵਿੱਚ ਅਸੀਂ ਮਿਰਚ ਘੱਟ ਪਾਉਂਦੇ ਹਾਂ ਅਸੀਂ ਅਤੇ ਜਿਵੇਂ ਕਿ ਕੁਝ ਰੈਸਪੀਆਂ ਅਜਿਹੀਆਂ ਹੁੰਦੀਆਂ ਹਨ ਜਿਵੇਂ ਕਿ ਸਾਡੇ ਪੰਜਾਬ ਲੋਕ ਮਾਹਿਰ ਹਨ ਜਿਨ੍ਹਾਂ ਵਿੱਚ ਜਿਵੇਂ ਕਿ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਇਹ ਪਕਵਾਨ ਹਰ ਕੋਈ ਨਹੀਂ ਬਣਾ ਸਕਦਾ ਜਿਵੇਂ ਕਿ ਕੁਝ ਰੈਸਪੀ ਅਸੀਂ ਵਿਦੇਸ਼ੀ ਰੈਸਪੀ ਵੀ ਬਣਾਉਂਦੇ ਹਾਂ ਜਿਨ੍ਹਾਂ ਵਿੱਚ ਸਾਨੂੰ ਸੁਹਾ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਉਹਦੇ ਲਈ ਸਾਡੇ ਕੋਲ ਸਮੱਗਰੀ ਵੀ ਪੂਰੀ ਨਹੀਂ ਹੁੰਦੀ ਅਤੇ ਕੁਝ ਟਾਈਮ ਵੀ ਪੂਰਾ ਨਹੀਂ ਹੁੰਦਾ ਇਸ ਲਈ ਸਾਨੂੰ ਟਾਈਮ ਦਾ ਵੀ ਔਰ ਸਮੱਗਰੀ ਦਾ ਵੀ ਧਿਆਨ ਦੇਣਾ ਪੈਂਦਾ ਹੈ ਜੇਕਰ ਜਿਵੇਂ ਕਿ ਕੋਈ ਚੀਜ਼ ਖਰਾਬ ਹੋ ਜਾਵੇ ਜਿਵੇਂ ਕਿ ਦੁੱਧ ਸੜ ਜਾਵੇ ਅਤੇ ਉਹਦੇ ਵਿੱਚ ਅਸੀਂ ਇਲਾਚੀ ਪਾਊਡਰ ਪਾ ਦਿੰਦੇ ਹਾਂ ਜਾਂ ਚਾਹ ਦਾ ਮਸਾਲਾ ਪਾ ਦਿੰਦੇ ਹਾਂ ਅਤੇ ਜੇਕਰ ਕੋਈ ਰੈਸਪੀ ਬਣਾਉਂਦੇ ਸਮੇਂ ਖਰਾਬ ਹੋ ਜਾਵੇ ਜਾਂ ਨਮਕ ਜ਼ਿਆਦਾ ਪੈ ਜਾਵੇ ਜਾਂ ਹਲਦੀ ਪੈ ਜਾਵੇ ਉਹਦੇ ਵਿੱਚ ਅਸੀਂ ਆਟੇ ਦਾ ਪੇੜਾ ਪਾ ਦਿੰਦੇ ਹਾਂ